ਸਾਡੇ ਤਾਂ ਪੰਜਾਬ ਦੇ ਵਿੱਚ ਮੋਸਟਲੀ ਮੱਝਾਂ ਅਤੇ ਗਾਵਾਂ ਦੀ ਵਰਤੋਂ ਜ਼ਿਆਦਾ ਵਾ ਅਤੇ ਇਹਨਾਂ ਦਾ ਦੁੱਧ ਜਿਹੜਾ ਵਾ ਮੱਝ ਦਾ ਦੁੱਧ ਜਿਹੜਾ ਗਾੜਾ ਹੁੰਦਾ ਬਹੁਤ ਜ਼ਿਆਦਾ ਅਤੇ ਜਿਹੜੇ ਗਾਂ ਵਾ ਗਾਂ ਦਾ ਦੁੱਧ ਪਤਲਾ ਹੁੰਦਾ ਵਾ ਅਤੇ ਸੋ ਜਿਹੜਾ ਪਤਲਾ ਦੁੱਧ ਹੈ ਗਾਂ ਦਾ ਉਹ ਮੋਸਟਲੀ ਇੱਕ ਤਾਂ ਹਜ਼ਮ ਛੇਤੀ ਹੋ ਜਾਂਦਾ ਇਸ ਕਰਕੇ ਉਹ ਛੋਟੇ ਬੱਚਿਆਂ ਨੂੰ ਜ਼ਿਆਦਾ ਗਾਂ ਦਾ ਦੁੱਧ ਦਿੱਤਾ ਜਾਂਦਾ ਅਤੇ ਪਤਲਾ ਹੋਣ ਕਰਕੇ ਅਤੇ ਨਾਲੇ ਬੱਚੇ ਉਹਦੇ ਨਾਲ ਐਕਟਿਵ ਰਹਿੰਦੇ ਆ ਉਹਨਾਂ ਦਾ ਜਿਹੜਾ ਸਰੀਰੀ ਵਿਕਾਸ ਆ ਬੱਚਿਆਂ ਦਾ ਉਹ ਗਾਂ ਦੇ ਦੁੱਧ ਨਾਲ ਜ਼ਿਆਦਾ ਵਧੀਆ ਹੁੰਦਾ ਅਤੇ ਜਿਹੜਾ ਮੱਝ ਦਾ ਦੁੱਧ ਹੈ ਉਹਦੇ 'ਚ ਫੈਟ ਵੱਧ ਹੋਣ ਕਰਕੇ ਉਹ ਮੋਸਟਲੀ ਵੱਡੇ ਤਾਂ ਯੂਜ ਕਰ ਸਕਦੇ ਆ ਅਤੇ ਬੱਚਿਆਂ ਨੂੰ ਜ਼ਿਆਦਾ ਗਾਂ ਦਾ ਦੁੱਧ ਹੀ ਦਿੱਤਾ ਜਾਂਦਾ ਵਾ ਅਤੇ ਮੱਝ ਦਾ ਜਿਹੜਾ ਦੁੱਧ ਹੈ ਉਹ ਮੋਸਟਲੀ ਦਹੀਂ ਵਗੈਰਾ ਅਤੇ ਉਹਦੇ 'ਚ ਯੂਜ ਕੀਤਾ ਜਾਂ ਘਿਓ ਬਣਾਇਆ ਜਾਂਦਾ ਇਹਦੇ ਦੁੱਧ ਤੋਂ ਮੱਝ ਦੇ ਤੋਂ ਅਤੇ ਤਕਰੀਬਨ ਵੱਡੇ ਹੀ ਜ਼ਿਆਦਾ ਪੀਂਦੇ ਆ ਦੁੱਧ ਇਹਦਾ ਦੁੱਧ ਵੀ ਪੀ ਸਕਦੇ ਆ ਪਰ ਜਿਹੜਾ ਗਾਂ ਦਾ ਦੁੱਧ ਆ ਉਹ ਜ਼ਿਆਦਾ ਗੁਣਕਾਰੀ ਆ ਅਤੇ ਉਹ ਬੱਚਿਆਂ ਲਈ ਜ਼ਿਆਦਾ ਯੂਜ ਕੀਤਾ ਜਾਂਦਾ ਬੱਚੇ ਐਕਟਿਵ ਰੱਖਣ ਲਈ ਦਿਮਾਗੀ ਜਿਹੜੀ ਪ੍ਰਕਿਰਿਆ ਉਹਨਾਂ ਦੀ ਬਹੁਤ ਤੇਜ਼ ਉਹਦੇ ਨਾਲ ਚੱਲਦੀ ਹੈ ਇਸ ਕਰਕੇ ਗਾਂ ਦਾ ਦੁੱਧ ਮੋਸਟਲੀ ਵਰਤਿਆ ਜਾਂਦਾ ਗਾਂ ਨੂੰ ਤਾਂ ਪੂਜਿਆ ਵੀ ਜਾਂਦਾ ਸਾਡੇ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਹੀ ਪੂਜਿਆ ਜਾਂਦਾ ਗਾਂ ਨੂੰ ਤਾਂ ਸੋ ਇਸ ਕਰਕੇ ਗਾਂ ਦਾ ਦੁੱਧ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ